ਇਲਾਕੇ ਵਿੱਚ ਵੱਧ ਰਹੇ ਅਪਰਾਧ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਸਰਕਾਰਾਂ ਦੀ ਨਾਕਾਮੀ ਅਤੇ ਸਰਕਾਰਾਂ ਦਾ ਸਰਕਾਰਾਂ ਦੀ ਸ਼ੈਅ ਕਾਰਨ ਹੀ ਅਪਰਾਧਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਇਸ ਦੀ ਬਹੁਤ ਵੱਡੀ ਉਦਾਹਰਨ ਨਾਮੀ ਕਲਾਕਾਰ ਖਿਡਾਰੀਆਂ ਅਤੇ ਹੋਰ ਨਾਮੀ ਚਿਹਰਿਆਂ ਦਾ ਕਤਲ ਹੋਣਾ ਉਦਾਹਰਨ ਹੈ ਅਪਰਾਧ ਦੀ ਗੱਲ ਕਰੀਏ ਤਾਂ ਅਪਰਾਧ ਵਾਲੇ ਰਸਤੇ ਕੋਈ ਵਿਅਕਤੀ ਇਸ ਕਾਰਨ ਤੁਰਦਾ ਹੈ ਜੋ ਗਰੀਬ ਜਾਂ ਗਰੀਬ ਜਾਂ ਬੇਰੁਜ਼ਗਾਰ ਹੋਵੇ ਇਸ ਤੋਂ ਇਲਾਵਾ ਸਰਕਾਰਾਂ ਦਾ ਬਹੁਤ ਵੱਡਾ ਬਹੁਤ ਵੱਡੀ ਅਹਿਮੀਅਤ ਹੈ ਅਪਰਾਧ ਅਤੇ ਬੇਰੁਜ਼ਗਾਰੀ ਲਈ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਸਰਕਾਰ ਨੂੰ ਵੱਖ ਵੱਖ ਤਰ੍ਹਾਂ ਦੇ ਰੁਜ਼ਗਾਰਾਂ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ ਫੈਕਟਰੀਆਂ ਜਾਂ ਹੋਰ ਰੁਜ਼ਗਾਰ ਦੇ ਸਾਧਨਾਂ ਨੂੰ ਵਾਧਾ ਦੇਣਾ ਚਾਹੀਦਾ ਹੈ ਸਰਕਾਰਾਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਘੱਟ ਦੇ ਕੇ ਹੋਰ ਆਪਣੇ ਫਾਇਦਿਆਂ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਉਪਰਾਲਿਆਂ ਵੱਲ ਵਧੇਰੇ ਧਿਆਨ ਦੇ ਰਹੀਆਂ ਹਨ ਜੋ ਇੱਕ ਗੰਭੀਰ ਮੁੱਦਾ ਹੈ